ਹੈਲੋ ਹਾਂਜੀ ਹਾਂਜੀ ਹਾਂਜੀ ਮੈਮ ਦਰਬਾਰ ਸਾਹਿਬ ਤੁਹਾਨੂੰ ਪਤਾ ਮੈਮ ਦਰਬਾਰ ਸਾਹਿਬ ਦਾ ਹਾਂਜੀ ਉੱਥੇ ਜਿੱਦਾਂ ਚਲੇ ਗਏ ਹਾਂਜੀ ਹਾਂਜੀ ਉੱਥੇ ਜਦੋਂ ਚਲੇ ਜਾਈਏ ਨਾ ਉੱਥੇ ਕਾਫ਼ੀ ਵੈਨ ਵਾਲੇ ਆਟੋ ਵਾਲੇ ਹੁੰਦੇ ਆ ਤੇ ਉਹ ਪਰ ਪਰਸਨ ਦੇ ਹਿਸਾਬ ਨਾਲ ਟਿਕਟ ਲੈ ਕੇ ਅਤੇ ਤੁਹਾਨੂੰ ਲੈ ਜਾਂਦੇ ਆ ਹਾਂਜੀ ਹਾਂਜੀ ਵਾਹਗਾ ਬੋਰਡਰ ਅਤੇ ਉੱਥੇ ਜਾਈਦਾ ਆ ਹਾਂਜੀ ਪਾਕਿਸਤਾਨ ਅਤੇ ਸਾਡੀ ਇੰਡੀਆ ਦਾ ਬੋਰਡਰ ਬਣਿਆ ਹੋਇਆ ਆ ਅਤੇ ਉੱਥੇ ਔਡੀਅਂਸ ਆਪਣੀ ਆਪਣੀ ਇੰਡੀਆ ਦੇ ਔਡੀਅਂਸ ਵੱਖਰੀ ਬੈਠੀ ਹੁੰਦੀ ਆ ਉੱਧਰ ਪਰਲੇ ਪਾਸੇ ਪਾਕਿਸਤਾਨ ਦੀ ਔਡੀਅਂਸ ਬੈਠੀ ਹੁੰਦੀ ਆ ਪਰੇਡ ਵਗੈਰਾ ਉਹ ਹੁੰਦੇ ਆ ਕਿ ਸਾਡੇ ਜਿਹੜੇ ਜਵਾਨ ਆ ਬੜੀ ਹਾਈਟ ਹੁੰਦੀ ਹੈ ਉਹਨਾਂ ਦੀ ਸਿਕਸ ਸਿਕਸ ਫੀਟ ਦੇ ਕੋਈ ਸੈਵਨ ਸੈਵਨ ਫੀਟ ਹੁੰਦੇ ਆ ਅਤੇ ਬੜੀ ਅੱਛੀ ਪਰੇਡ ਹੁੰਦੀ ਆ ਉੱਥੇ ਲੱਗ ਜਾਂਦਾ ਆ ਜਾਮ ਘੰਟਾ ਡੇਢ ਘੰਟਾ ਲੱਗ ਹੀ ਜਾਂਦਾ ਆ ਉੱਥੇ ਹਾਂਜੀ ਇੱਥੋਂ ਜਾਣ ਲੱਗੇ ਵੀ ਤੁਹਾਨੂੰ ਅੱਧਾ ਘੰਟਾ ਲੱਗਣਾ ਹਾਂਜੀ ਹਾਂਜੀ ਜੇ ਤੁਸੀਂ ਟਾਈਮ ਸਿਰ ਪਹੁੰਚੇ ਹੋਵੋਗੇ ਕਿ ਸਾਨੂੰ ਹਨੇਰਾ ਵੀ ਨਾ ਹੋਵੇ ਅਤੇ ਉੱਥੇ ਜਿਹੜੀ ਸੈਰਮਨੀ ਨਾ ਉਹ ਪੰਜ ਵਜੇ ਤੱਕ ਹੀ ਹੁੰਦੀ ਜੇ ਹਾਂਜੀ ਹਾਂਜੀ ਹਾਂਜੀ ਜੇ ਤੁਸੀਂ ਆਪਾਂ ਸਵੇਰੇ ਹੀ ਦਰਬਾਰ ਸਾਹਿਬ ਚਲੇ ਜਾਵਾਂਗੇ ਦੁਪਹਿਰ ਉੱਥੇ ਪਹੁੰਚ ਜਾਵਾਂਗੇ ਤਾਂ ਫਿਰ ਹੋ ਜਾਵੇਗਾ ਹਾਂਜੀ ਹਾਂਜੀ ਹਾਂਜੀ ਹਾਂਜੀ ਠੀਕ ਆ ਜੀ ਠੀਕ ਆ ਜੀ ਹਾਂਜੀ ਠੀਕ ਆ ਜੀ ਹਾਂਜੀ ਹਾਂਜੀ ਓਕੇ